ਨਹੀਂ ਜੀ ਪੰਜਾਬੀ ਬੋਲਣ ਅਤੇ ਲਿਖਣ ਵੇਲੇ ਕਦੀ ਵੀ ਕਿਸੇ ਮੁਸ਼ਕਿਲ ਦੀ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਸ਼ੁਰੂ ਤੋਂ ਹੀ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਆ ਜੇਕਰ ਅਸੀਂ ਪੰਜਾਬੀ ਵਿੱਚ ਹੀ ਨਹੀਂ ਬੋਲ ਸਕਦੇ ਹਾਂ ਫਿਰ ਹੋਰ ਵੀ ਕੀ ਕਰ ਸਕਦੇ ਹਾਂ ਸਾਡੀ ਪਹਿਚਾਣ ਪੰਜਾਬੀ ਆ ਸਾਡੀ ਮਾਤ ਭਾਸ਼ਾ ਪੰਜਾਬੀ ਆ ਸਕੂਲ ਵਿੱਚ ਵੀ ਸ਼ੁਰੂ ਤੋਂ ਹੀ ਪੰਜਾਬੀ ਮੀਡੀਅਮ ਹੀ ਲਿਆ ਜੇਕਰ ਅਸੀਂ ਹੀ ਪੰਜਾਬੀ ਨਹੀਂ ਬੋਲਾਂਗੇ ਤਾਂ ਕੋਈ ਹੋਰ ਕਿਵੇਂ ਬੋਲੂਗਾ ਸਾਡਾ ਸੱਭਿਆਚਾਰ ਸਾਡਾ ਰਹਿਣ ਸਹਿਣ ਸਾਡਾ ਪਹਿਰਾਵਾ ਸਭ ਕੁਛ ਹੀ ਪੰਜਾਬੀ ਹੈ ਪੰਜਾਬ ਦੇ ਲੋਕਾਂ ਮੈਨੂੰ ਆਪਣੀ ਪੰਜਾਬੀ ਬੋਲੀ 'ਤੇ ਮਾਣ ਹੈ ਮੈਂ ਬਹੁਤ ਖੁਸ਼ ਹਾਂ ਵੀ ਮੈਂ ਪੰਜਾਬ ਵਿੱਚ ਜੰਮੀ ਪਲੀ ਹਾਂ ਪੰਜਾਬੀ ਬੋਲਦੀ ਹਾਂ ਮੈਂ ਪੰਜਾਬੀ ਨੂੰ ਪ੍ਰਮੋਟ ਵੀ ਕਰਦੀ ਹਾਂ ਮੈਂ ਹਰ ਕੰਮ ਲਿਖਣ ਪੜ੍ਹਨ ਦਾ ਪੰਜਾਬੀ ਵਿੱਚ ਕਰਕੇ ਬਹੁਤ ਖੁਸ਼ ਹਾਂ ਮੈਂ ਫਰੀ ਟਾਈਮ 'ਤੇ ਹੋ ਕੇ ਪੰਜਾਬੀ ਪੜ੍ਹਦੀ ਹਾਂ ਨਾਵਲ ਪੜ੍ਹਦੀ ਹਾਂ ਕੁਛ ਅਖ਼ਬਾਰ ਵੀ ਪੰਜਾਬੀ ਪੜ੍ਹਦੀ ਹਾਂ ਔਰ ਬੱਚਿਆਂ ਨੂੰ ਵੀ ਪੰਜਾਬੀ ਭਾਸ਼ਾ ਬੋਲਣ 'ਤੇ ਜ਼ੋਰ ਦਿੰਦੀ ਹਾਂ ਤਾਂ ਜੋ ਬੱਚੇ ਆਪਣੀ ਮਾਤ ਭਾਸ਼ਾ ਦੇ ਨਾਲ ਜੁੜੇ ਰਹਿਣ ਔਰ ਉਹਨਾਂ ਨੂੰ ਆਪਣੀ ਭਾਸ਼ਾ ਆਪਣੀ ਹਿਸਟਰੀ ਆਪਣੇ ਰਹਿਣ ਸਹਿਣ 'ਤੇ ਮਾਣ ਮਹਿਸੂਸ ਹੋਵੇ ਜੇਕਰ ਉਹ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣਗੇ ਉਹ ਆ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਬਹੁਤ ਕੁਛ ਉਹਨਾਂ ਨੂੰ ਸਮਝਾ ਸਕਦੇ ਹਾਂ ਸਾਡੀ ਮਤਲਬ ਕਿ ਜਿਹੜਾ ਸੱਭਿਆਚਾਰ ਆ ਉਹ ਬਹੁਤ ਲੰਮੀਆਂ ਲੰਬੀਆਂ ਪੀੜ੍ਹੀਆਂ ਤੱਕ ਜਿੰਦਾ ਰਹਿ ਸਕਦਾ ਹੈ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਬਾਰੇ ਦੱਸਾਂਗੇ ਤਾਂ ਹੀ ਉਹਨਾਂ ਨੂੰ ਅੱਗੇ ਆਪਣੇ ਉਹ ਬੱਚਿਆਂ ਨੂੰ ਦੱਸੂਗਾ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਊਗਾ ਪੰਜਾਬੀ ਪੜ੍ਹਨ ਵਿੱਚ ਮੈਂ ਆਪਣਾ ਕੋਈ ਵੀ ਬੇਇੱਜ਼ਤੀ ਨਹੀਂ ਮਹਿਸੂਸ ਕਰਦੀ ਸਗੋਂ ਮਾਣ ਮਹਿਸੂਸ ਕਰਦੀ ਹਾਂ ਵੀ ਮੈਂ ਇੱਕ ਪੰਜਾਬ ਦੀ ਧੀ ਹਾਂ ਔਰ ਮੈਂ ਪੰਜਾਬੀ ਬੋਲ ਸਕਦੀ ਹਾਂ ਅਤੇ ਲਿਖ ਸਕਦੀ ਹਾਂ ਪੜ੍ਹ ਸਕਦੀ ਹਾਂ ਅਤੇ ਕਰ ਸਕਦੀ ਹਾਂ